ਹੈਲੋ ਮੈਂ ਜੀ ਬਾਬਾ ਸਾਹਿਬ ਚੌਂਕ ਗਲੀ ਜੀਵਨ ਸਿੰਘ ਤੋਂ ਬੋਲ ਰਹੀ ਹਾਂ ਅਤੇ ਜੀਵਨ ਸਿੰਘ ਤੋਂ ਬੋਲ ਰਹੀ ਹਾਂ ਮੈਂ ਕੈਬ ਬੁੱਕ ਕਰਵਾਉਣੀ ਆ ਹਾਂਜੀ ਤੁਹਾਡਾ ਨਾਮ ਕੀ ਹੈ ਅਰੁਣ ਮੇਰਾ ਨਾਮ ਰਸ਼ਮੀ ਹੈ ਅਤੇ ਮੈਂ ਜਾਣਾ ਹੈ ਜੀ ਬਾਹਰ ਆਊਟ ਆਫ ਸਟੇਸ਼ਨ ਜਾਣਾ ਮੈਨੂੰ ਤੁਸੀਂ ਸਟੇਸ਼ਨ ਤੱਕ ਛੱਡ ਦੋਗੇ ਕਿੰਨੇ ਪੈਸੇ ਸਾਢੇ ਤਿਨ ਸੌ ਚਲੋ ਕੋਈ ਗੱਲ ਨਹੀਂ ਤੁਸੀਂ ਸਾਢੇ ਤਿੰਨ ਸੌ ਲੈ ਲਓ ਅਤੇ ਪਰ ਹਾਂ ਮੁਸ਼ਕਿਲ ਹੈ ਕਿ ਮੇਰੀ ਗਲੀ ਬਹੁਤ ਛੋਟੀ ਹੈ ਅਤੇ ਗੱਡੀ ਅ ਅੰਦਰ ਤਾਂ ਨਹੀਂ ਆ ਸਕਦੀ ਪਰ ਮੈਂ ਗਲੀ ਦੇ ਬਾਹਰ ਹੀ ਆ ਜਾਂਗੀ ਮੇਨ ਚੌਂਕ ਦੇ ਵਿੱਚ ਤੁਸੀਂ ਸ਼ਹੀਦਾਂ ਸਾਹਿਬ ਚੌਂਕ ਆਓਗੇ ਨਹੀਂ ਉੱਥੋਂ ਤੱਕ ਫਿਰ ਮੈਨੂੰ ਈ ਰਿਕਸ਼ਾ 'ਚ ਆਉਣਾ ਪਵੇਗਾ ਕੋਸ਼ਿਸ਼ ਕਰੋ ਕਿ ਤੁਸੀਂ ਅੰਦਰ ਅੰਦਰ ਥੋੜ੍ਹਾ ਚਲੋ ਭੀੜਾ ਬਾਜ਼ਾਰ ਹੈ ਚਲੋ ਕੋਈ ਗੱਲ ਨਹੀਂ ਮੈਂ ਸ਼ਹੀਦਾਂ ਤੱਕ ਆ ਜਾਂਗੀ ਫਿਰ ਅੱਗੋ ਤੁਸੀਂ ਮੈਨੂੰ ਸਟੇਸ਼ਨ ਤੱਕ ਕਿਉਂਕਿ ਮੇਰੇ ਕੋਲ ਲਗਜ ਵੀ ਹੈ ਫਿਰ ਇਸ ਕਰਕੇ ਮੁਸ਼ਕਿਲ ਹੈ ਮੈਂ ਕੋਸ਼ਿਸ਼ ਸੀਗੀ ਕਿ ਤੁਸੀਂ ਗਲੀ ਬਾਹਰ ਹੀ ਆ ਜਾਓ ਕਿਉਂਕਿ ਸਮਾਨ ਜ਼ਿਆਦਾ ਹੈ ਨਾਲ ਫੈਮਿਲੀ ਹੈ ਪਲੀਜ਼ ਤੁਸੀਂ ਆ ਜਾਓ ਕਿੰਨੀ ਦੇਰ 'ਚ ਘੰਟੇ ਤੱਕ ਨਹੀਂ ਜੀ ਘੰਟਾ ਬਹੁਤ ਜ਼ਿਆਦਾ ਹੋ ਜਾਂਦਾ ਕੋਸ਼ਿਸ਼ ਕਰੋ ਕਿ ਅੱਧੇ ਘੰਟੇ ਤੱਕ ਪੰਦਰਾਂ ਵੀਹ ਮਿੰਟਾਂ ਦੇ ਵਿੱਚ ਹੀ ਮੈਂ ਪਹੁੰਚਣਾ ਮੇਰੀ ਟ੍ਰੇਨ ਹੈ ਟ੍ਰੇਨ ਨਹੀਂ ਤਾਂ ਫਿਰ ਛੁੱਟ ਜਾਵੇਗੀ ਫਿਰ ਮੁਸ਼ਕਿਲ ਹੋ ਜਾਵੇਗੀ ਮੇਰੀ ਟ੍ਰੇਨ ਹੈ ਜੀ ਢਾਈ ਵਜੇ ਦੀ ਕਮ ਸੇ ਕਮ ਤੁਸੀਂ ਡੇਢ ਵਜੇ ਤਾਂ ਪਹੁੰਚੋ ਡੇਢ ਵਜੇ ਆਓਗੇ ਤਾਂ ਹੀ ਤਾਂ ਅਸੀਂ ਸਟੇਸ਼ਨ ਤੱਕ ਕਿਉਂਕਿ ਰਸਤੇ ਵਿੱਚ ਰਸ਼ ਵੀ ਬਹੁਤ ਜ਼ਿਆਦਾ ਹੁੰਦਾ ਇਸ ਕਰਕੇ ਥੋੜ੍ਹੀ ਜਲਦੀ ਆਓਗੇ ਤਾਂ ਹੀ ਤਾਂ ਅਸੀਂ ਪਹੁੰਚ ਪਾਵਾਂਗੇ ਪੈਸੇ ਵੱਲੋਂ ਕੋਈ ਦਿੱਕਤ ਨਹੀਂ ਹੈ ਤੁਸੀਂ ਪਲੀਜ਼ ਜਲਦੀ ਆ ਜਾਓ ਮੇਰੀ ਰਿਕੁਐਸਟ ਹੈ ਹਾਂਜੀ